ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਨਾ ਫਤਿਹਗੜ੍ਹ ਸਾਹਿਬ ਨਿਊ ਮਕਾਨ ਲਿਆ ਸਰ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਇੱਥੇ ਦਾ ਮਾਹੌਲ ਕਿੱਦਾਂ ਦਾ ਇੱਥੇ ਦਾ ਇਤਿਹਾਸ ਦੱਸ ਸਕਦੇ ਹੋ ਮੈਨੂੰ ਨੌਲੇਜ ਦਿਉ ਥੋੜ੍ਹੀ ਬਹੁਤ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਸਰ ਠੀਕ ਆ ਸਰ

ਹ ਹ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਠੀਕ ਆ ਸਰ

ਅਤੇ ਇੱਥੋਂ ਰੇਲਵੇ ਸਟੇਸ਼ਨ ਅਤੇ ਸਰ ਬੱਸ ਸਟੈਂਡ ਕਿੰਨੀ ਕੁ ਦੂਰ ਹੈ

ਠੀਕ ਹੈ ਜੀ ਹਾਂਜੀ

ਠੀਕ ਹੈ ਜੀ ਫਿਰ ਸਰ ਮੈਂ ਅਗਲੇ ਸਾਲ ਨਿਊ ਈਅਰ ਵਿਜਿਟ ਕਰੂੰਗਾ ਇੱਥੇ ਅਤੇ ਠੀਕ ਹੈ